ਸਥਾਨਕ ਜਾਂ ਰਾਸ਼ਟਰੀ ਪੱਧਰ 'ਤੇ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਇਹ ਪ੍ਰੋਗਰਾਮ ਸਟੇਡੀਅਮਾਂ ਗਰਾਊਂਡਾਂ ਰਨੇਸਾਂ ਵਿੱਚ ਕਰਾਏ ਜਾਂਦੇ ਹਨ ਸਮਾਗਮਾਂ ਵਿੱਚ ਮੁੱਖ ਮਹਿਮਾਨ ਭਾਗ ਲੈਂਦੇ ਹਨ ਸਮਾਗਮਾਂ ਨੂੰ ਦੇਖਣ ਲਈ ਬਹੁਤ ਸਾਰੇ ਲੋਕ ਆਉਂਦੇ ਹਨ ਰਾਸ਼ਟਰੀ ਪੱਧਰ 'ਤੇ ਜਿਵੇਂ ਕਿ ਪੰਦਰਾਂ ਅਗਸਤ ਛੱਬੀ ਜਨਵਰੀ ਆਦਿ ਇਸ ਤਰ੍ਹਾਂ ਦੇ ਹੋਰ ਕਈ ਪ੍ਰੋਗਰਾਮ ਰਾਸ਼ਟਰੀ ਪੱਧਰ 'ਤੇ ਮਨਾਏ ਜਾਂਦੇ ਹਨ ਇਹਨਾਂ ਪ੍ਰੋਗਰਾਮਾਂ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਧਾਨ ਮੰਤਰੀ ਆਦਿ ਐੱਮ ਐੱਲ ਏ ਆਦਿ ਭਾਗ ਲੈਂਦੇ ਹਨ ਮੁੱਖ ਮੰਤਰੀ ਸਾਹਿਬ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ ਇਸ ਨੂੰ ਦੇਖਣ ਲਈ ਬਹੁਤ ਸਾਰੇ ਲੋਕ ਆਉਂਦੇ ਹਨ ਇਸ ਤਰ੍ਹਾਂ ਰਾਸ਼ਟਰੀ ਪੱਧਰ 'ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਸਥਾਨਕ ਪੱਧਰ 'ਤੇ ਵੀ ਛੋਟੇ ਮੋਟੇ ਕਈ ਪ੍ਰੋਗਰਾਮ ਹੁੰਦੇ ਹਨ ਜੋ ਕਿ ਪਿੰਡਾਂ ਵਿੱਚ ਕਰਵਾਏ ਜਾਂਦੇ ਹਨ ਜਿਵੇਂ ਕਿ ਕੁਛ ਮੇਲੇ ਤਿਉਹਾਰ ਲੋਹੜੀ ਰਾਮਲੀਲਾ ਆਦਿ ਪ੍ਰੋਗਰਾਮ ਹੁੰਦੇ ਹਨ ਇਹਨਾਂ ਵਿੱਚ ਮੁੱਖ ਮਹਿਮਾਨ ਵਜੋਂ ਪਿੰਡ ਦੇ ਪੰਚ ਸਰਪੰਚ ਹੁੰਦੇ ਹਨ ਹੋਰ ਪਿੰਡ ਦੇ ਮੋਹਤਬਾਰ ਬੰਦੇ ਹੁੰਦੇ ਹਨ ਇਹਨਾਂ ਨੂੰ ਵੇਖਣ ਲਈ ਵੀ ਪਿੰਡ ਦੇ ਲੋਕ ਇਕੱਠੇ ਹੁੰਦੇ ਹਨ